ਹੈਲੋ ਅਸੀਂ ਸਿੰਚਾਈ ਵਿਭਾਗ ਤੋਂ ਬੋਲਦੇ ਹਾਂ ਹਾਂਜੀ ਹਾਂਜੀ ਹਾਂਜੀ ਹਾਂ ਵੀ ਜਿਹੜੇ ਪਿਛਲੇ ਸਾਲ ਹੜ ਆਏ ਸੀ ਹਾਂ ਹੜਾਂ ਨੇ ਤਾਂ ਬਹੁਤ ਜ਼ਿਆਦਾ ਨੁਕਸਾਨ ਕੀਤਾ ਜਿਵੇਂ ਹਾਂ ਹੜਾਂ ਨਾਲ ਫਸਲਾਂ ਤਾਂ ਕਿ ਹੋਇਆ ਨੁਕਸਾਨ ਉਹਨਾਂ ਦਾ ਤਾਂ ਹੋਇਆ ਹੀ ਹੈ ਕਿਸਾਨਾਂ ਨੂੰ ਵੀ ਬਹੁਤ ਫਰਕ ਪਿਆ ਹੈਗਾ ਇਹਦਾ ਜਿਵੇਂ ਤਾਂ ਜ਼ਿਆਦਾਤਰ ਜਿਵੇਂ ਕੀ ਨਾਮ ਹੈਗੇ ਆ ਵੀ ਇੱਧਰਲੀ ਸਾਈਡ ਹੋਇਆ ਪੰਜਾਬ ਦੇ ਵਿੱਚ ਜਿਵੇਂ ਆਪਣੇ ਬਿਆਸ ਵਾਲੇ ਪਾਸੇ ਜਿਵੇਂ ਹੇਮਕੁੰਟ ਸਾਹਿਬ ਵਾਲੇ ਪਾਸੇ ਉੱਤਰਾਖੰਡ ਇੱਧਰ ਇੱਧਰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੰਨਾਂ ਕਿੰਨਾ ਹੈਗੇ ਆ ਵੀ ਇੰਨਾਂ ਇੱਧਰ ਪਾਣੀ ਇੰਨਾਂ ਹੋ ਗਿਆ ਸੀ ਵੀ ਜਿਵੇਂ ਘਰਾਂ ਦੇ ਘਰ ਢਹਿ ਗਏ ਲੋਕ ਛੱਤਾਂ 'ਤੇ ਚੜ੍ਹ ਚੜ੍ਹ ਮਤਲਬ ਰਹਿੰਦੇ ਸੀਗੇ ਨਾ ਕੋਈ ਖਾਣ ਪੀਣ ਦਾ ਉਹਨਾਂ ਨੂੰ ਇੱਦਾਂ ਸੀ ਮਿਲਦਾ ਕੋਈ ਅਗਲਿਆਂ ਨੇ ਕਿਵੇਂ ਹੈਗਾ ਜਿਵੇਂ ਕਿਸੇ ਨੇ ਕਿੱਦਾਂ ਉਹਨਾਂ ਨੂੰ ਰਾਸ਼ਨ ਪਹੁੰਚਾਇਆ ਅਤੇ ਉਹ ਉਹਨਾਂ ਨੁਕਸਾਨ ਤਾਂ ਹੋਇਆ ਹੀ ਇਹਨਾਂ ਦੇ ਨਾਲ ਹਾਂ ਦੇਖੋ ਸਰਕਾਰ ਨੇ ਇਹ ਤਾਂ ਦੇਖੋ ਕੁਦਰਤੀ ਕਹਿਰ ਹੈ ਹੈ ਨਾ ਇਹਦੇ ਵਿੱਚ ਕਿਸੇ ਦਾ ਤਾਂ ਵੀ ਕੋਈ ਕਸੂਰ ਨਹੀਂ ਗਾ ਇਹ ਤਾਂ ਕੁਦਰਤੀ ਕਹਿਰ ਹੈ ਇਹ ਤਾਂ ਆਪਾਂ ਕੁਛ ਵੀ ਨਹੀਂ ਕਹਿ ਸਕਦੇ ਜਿਵੇਂ ਦਰਿਆਵਾਂ ਚ ਦਾ ਪਾਣੀ ਚੜ੍ਹਨਾ ਹੈ ਨਾ ਇਹਦੇ ਵਿੱਚ ਸਰਕਾਰ ਨੇ ਤਾਂ ਕੁਛ ਵੀ ਨਹੀਂ ਕੀਤਾ ਜਿਵੇਂ ਦੇਖਿਆ ਜਾਵੇ ਤਾਂ ਹਾਂ ਇਹਨਾਂ ਮਦਦ ਤਾਂ ਜ਼ਰੂਰ ਕੀਤੀ ਸਰਕਾਰਾਂ ਨੇ ਫਾਇਦਾ ਤਾਂ ਵੀ ਜਿਸ ਹਿਸਾਬ ਨਾਲ ਮੌਕੇ ਦੇ ਹਿਸਾਬ ਨਾਲ ਸਰਕਾਰਾਂ ਨੇ ਸਹੂਲਤਾਂ ਤਾਂ ਬਹੁਤ ਦਿੱਤੀਆਂ ਹੈਗੀਆਂ ਕਿਸਾਨਾਂ ਨੂੰ ਵੀ ਹਾਂ ਹਾਂ ਉਹ ਵੀ ਦੇਖ ਲਓ ਅਕਸਰ ਤਾਂ ਕਿ ਮੈਂ ਹੈਗਾ ਸਰਕਾਰਾਂ ਨੇ ਬਚਾਇਆ ਹੀ ਹੈ ਵੀ ਚਾਹੇ ਪੈਕਿੰਗ ਕਰਕੇ ਚਾਹੇ ਕਿਵੇਂ ਨੁਕਸਾਨ ਜਿਹੜਾ ਹੋਣਾ ਸੀ ਉਹ ਤਾਂ ਹੈ ਨਾ ਵੀ ਉਹ ਤਾਂ ਕਿਸੇ ਦੇ ਵੀ ਪਾਸੇ ਨਹੀਂ ਰਿਹਾ ਇਹ ਚੀਜ਼ ਕੁਦਰਤ ਹੀ ਸੀਗੀ ਹਾਂ ਹਾਂ ਲੋਕ ਤਾਂ ਬਹੁਤ ਬੇਘਰ ਹੋਏ ਹਾਂ ਘਰਾਂ ਦੇ ਘਰ ਢਹਿ ਗਏ ਢਹਿ ਗਏ ਸੀ ਘਰਾਂ ਦੇ ਘਰ ਢਏ ਸੀਗੇ ਹਮ ਹਾਂ ਹਾਂ ਹਾਂ ਕਈ ਤਾਂ ਵਿਚਾਰੇ ਉੱਦਾਂ ਹੀ ਕੀ ਨਾਮ ਹੈਗੇ ਬਥੇਰੇ ਆਪ ਵੀ ਬਹੁਤ ਰੁੜੇ ਆ ਇਹਦੇ ਵਿੱਚ ਕੀ ਹੈ ਪਾਣੀ ਦਾ ਵਹਾਅ ਜਿੰਨਾ ਤੇਜ਼ ਸੀ ਜਿਵੇਂ ਬਹੁਤ ਜ਼ਿਆਦਾ ਵੀ ਨੁਕਸਾਨ ਹੋਇਆ ਗੱਡੀਆਂ ਅਤੇ ਗੱਡੀਆਂ ਰੁੜੀਆਂ ਹਾਂ ਹਾਂ ਹਾਂ ਉੱਧਰ ਵੀ ਇੱਦਾਂ ਹੀ ਨੁਕਸਾਨ ਹੜ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਸੀ ਨਹੀਂ ਹਾਂ ਹਾਂ ਠੀਕ ਹੈ ਹਾਂ ਚਲੋ ਠੀਕ ਹੈ ਜੀ